ਸਾਡੇ ਇਲਾਕੇ ਵਿੱਚ ਕਈ ਤਰ੍ਹਾਂ ਦੇ ਅਪਰਾਧ ਹੋ ਰਹੇ ਹਨ ਜੇ ਗਲ ਜੇਕਰ ਗੱਲ ਕਿਸੇ ਚੋਰੀ ਦੀ ਸਾਡੇ ਇਲਾਕੇ ਵਿੱਚ ਕੱਲ੍ਹ ਹੀ ਇੱਕ ਚੋਰੀ ਹੋਈ ਆ ਉੱਥੇ ਦਿਨ ਦਿਹਾੜੇ ਹੀ ਉਹਨਾਂ ਦੇ ਘਰੋਂ ਸਿਲੰਡਰ ਚੁੱਕ ਕੇ ਲੈ ਗਏ ਅਤੇ ਉਹਨਾਂ ਦਾ ਮੋਟਰਸਾਈਕਲ ਵੀ ਘਰੋਂ ਹੀ ਚੱਕ ਕੇ ਲੈ ਕੇ ਅਤੇ ਸਾਡੇ ਗੁਆਂਢ ਵਿੱਚ ਇੱਕ ਕਬਾੜੀਆ ਹੈ ਜਿਹਦੀ ਰਾਤ ਨੂੰ ਬੈਟਰੀ ਖੋਲ੍ਹ ਕੇ ਲੈ ਗਏ ਅਤੇ ਇਸ ਤਰ੍ਹਾਂ ਕਾਫੀ ਹੀ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਅਤੇ ਚੋਰੀ ਚੋਰੀਆਂ ਬੇਰੁਜ਼ਗਾਰੀ ਦਾ ਕਾਰਨ ਹਨ ਅਤੇ ਅੱਜ ਕੱਲ੍ਹ ਦੇ ਬੱਚੇ ਨਸ਼ਿਆਂ ਵਿੱਚ ਲੱਗ ਗਏ ਹਨ ਉਹਨਾਂ ਨੂੰ ਚੋਰੀ ਕਰਨਾ ਸਹੀ ਲੱਗਦਾ ਹੈ ਅਤੇ ਉਹ ਇਹ ਇੱਦਾਂ ਦੇ ਗਲਤ ਕੰਮਾਂ ਵਿੱਚ ਪੈ ਗਏ ਹਨ ਜੋ ਕਿ ਗਲਤ ਗੱਲ ਹੈ